ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਹੁਣ ਮੈਨੂੰ ਨਹੀਂ ਲੱਗਦਾ ਵੀ ਇੱਕ ਦੂਸਰੇ ਦੀ ਭਾਸ਼ਾ ਸਮਝਣੀ ਕੋਈ ਬਹੁਤੀ ਔਖੀ ਹੈ ਐਵੇਂ ਪੰਜਾਬ ਦੇ ਵਿੱਚ ਹੈ ਭਾਰਤ ਦੇ ਵਿੱਚ ਲਗਭਗ ਸਾਰੇ ਰਾਜਾਂ ਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ ਜੇਕਰ ਕੋਈ ਪੰਜਾਬ ਦੇ ਵਿੱਚ ਕੋਈ ਹੋਰ ਸਟੇਟ ਤੋਂ ਕੋਈ ਬੰ ਵਿਅਕਤੀ ਆਉਂਦਾ ਜਾਂ ਉਹ ਇੱਥੇ ਬ ਆਪਣੀ ਭਾਸ਼ਾ ਬੋਲਦਾ ਹਿੰਦੀ ਬੋਲਦਾ ਤਾਂ ਪੰਜਾਬੀ ਲੋਕ ਨੇ ਜਿਹੜੀ ਥੋੜ੍ਹੀ ਬਹੁਤੀ ਪੰਜਾਬੀ ਅਤੇ ਉਹਦੇ ਵਿੱਚ ਥੋੜ੍ਹੀ ਬਹੁਤੀ ਹਿੰਦੀ ਮਿਕਸ ਕਰਕੇ ਸਾਹਮਣੇ ਵਾਲੇ ਨੂੰ ਉਹਦੀ ਭਾਸ਼ਾ ਦੇ ਵਿੱਚ ਉਹਦੀ ਗੱਲ ਸਮਝਾ ਦਿੰਦੇ ਨੇ ਪਰ ਜੇ ਫਿਰ ਵੀ ਕੋਈ ਹੋਰ ਭਾਸ਼ਾ ਹੈਗੀ ਆ ਜਿਵੇਂ ਮਰਾਠੀ ਹੈ ਜਾਂ ਕੋਈ ਕੰਨੜ ਬੋਲ ਰਿਹਾ ਤਾਂ ਅੱਜ ਕੱਲ੍ਹ ਫੋਨਾਂ ਦੇ ਵਿੱਚ ਜਿਹੜੇ ਟਰਾਂਸਲੇਟਰ ਡਾਊਨਲੋਡ ਕਰ ਲਏ ਜਾਂਦੇ ਨੇ ਅਤੇ ਪੰਜਾਬੀ ਲੋਕ ਵੀ ਆਪਣੀ ਜਿਹੜੀ ਬੋਲੀ ਹੈ ਲੈਂਗੁਏਜ ਹੈ ਉਹ ਬੋਲ ਕੇ ਟਰਾਂਸਲੇਟਰ ਦੇ ਥਰੂ ਅਗਲੇ ਨੂੰ ਸਮਝਾ ਦਿੰਦੇ ਹੈ ਤਾਂ ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਹਾਂ ਜੇ ਕੋਈ ਬਾਹਰੋਂ ਘੁੰਮਣ ਆ ਰਿਹਾ ਅਤੇ ਉਹ ਇੰਗਲਿਸ਼ ਬੋਲ ਰਿਹਾ ਅੱਜ ਕੱਲ੍ਹ ਸਾਰੇ ਪੜ੍ਹੇ ਲਿਖੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਇੰਗਲਿਸ਼ ਸਮਝਣਾ ਕੋਈ ਬਹੁਤਾ ਔਖਾ ਕੰਮ ਨਹੀਂ ਉਹਨਾਂ ਲਈ ਉਹ ਸਮਝ ਜਾਂਦੇ ਹੈ ਅਤੇ ਪਰ ਜੇ ਫਿਰ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਪੁਰਾਣੇ ਬਜ਼ੁਰਗ ਨੇ ਉਹ ਕੋਈ ਇਹੋ ਜਿਹਾ ਕੋਈ ਨਵਾਂ ਨੌਜਵਾਨ ਲੱਭਦੇ ਜਿਹਨੂੰ ਇੰਗਲਿਸ਼ ਆਉਂਦੀ ਹੁੰਦੀ ਜਾਂ ਕੋਈ ਪਿੰਡ 'ਚ ਇਹੋ ਜਿਹਾ ਬੰਦਾ ਲੱਭ ਲੈਂਦੇ ਹੈ ਵੀ ਜਿਹਨੂੰ ਪੰ ਇੰਗਲਿਸ਼ ਪ੍ਰੋਪਰ ਸਮਝ ਆਉਂਦੀ ਹੈ ਤਾਂ ਉਹਦੇ ਰਾਹੀਂ ਉਹ ਉਸ ਦੀ ਗੱਲ ਸਮਝ ਲੈਂਦੇ ਨੇ ਹੁਣ ਅਖੀਰ 'ਚ ਮੈਂ ਇਹੀ ਕਹਾਂਗੀ ਵੀ ਮੈਨੂੰ ਨਹੀਂ ਲੱਗਦਾ ਹੈਗਾ ਵੀ ਕੋਈ ਇਹ ਬਹੁਤਾ ਔਖਾ ਕੰਮ ਹੈ ਵੀ ਅੱਜ ਕੱਲ੍ਹ ਕਿਸੇ ਨੂੰ ਆਪਣੀ ਭਾਸ਼ਾ ਸਮਝਾਉਣਾ ਜਾਂ ਸਮਝਣਾ ਤਾਂ ਹਰੇਕ ਵਿਅਕਤੀ ਅੱਜ ਦੇ ਟਾਈਮ 'ਚ ਸਮਝੀ ਜਾਂਦਾ ਪੰਜਾਬੀ ਲੋਕ ਵੀ ਐਵੇਂ ਸਮਝ ਜਾਂਦੇ ਅਤੇ ਸਮਝਾ ਵੀ ਦਿੰਦੇ ਆ